ਹੈਲੋ ਹਾਂਜੀ

ਆਪਣੇ ਨਾ ਬੱਚਾ ਵਾ ਉਹ ਫੋਨ ਜਿਆਦਾ ਦੇਖਦਾ ਵਾ ਤੇ ਉਹ ਥੋੜਾ ਚਿੜਚਿੜਾਪਣ ਵੀ ਉਹਦੇ ਚ ਹੈਗਾ ਵਾ ਵੀ ਉਹਨੂੰ ਘਰ ਦਾ ਉਹ ਕੁਛ ਨਹੀਂ ਖਾਂਦਾ ਹੈਗਾ ਬਾਹਰਲਾ ਖਾਂਦਾ ਹੈਗਾ ਵਾ ਤੇ ਉਹਦੇ ਵਾਸਤੇ ਅਸੀਂ ਪੁੱਛਣਾ ਵੀ ਆਪਾਂ ਨੂੰ ਕੀ ਉਹਦਾ ਮਤਲਬ ਤੁਸੀਂ ਕਰ ਸਕਦੇ ਆ ਹੈਲਪ ਕੀ ਕਰ ਸਕਦੇ ਬੱਚੇ ਦੀ ਹੈਗੀ ਬਾਰਾਂ ਕ ਸਾਲ ਉਮਰ ਬੇਟੀ ਆ

ਜੀ

ਨਹੀਂ ਜਿਹੜਾ ਆਪਾਂ ਨੂੰ ਜਿਆਦਾ ਬੱਚੇ ਦਾ ਜੀ

ਹਾਂ ਠੀਕ ਆ ਧੰਨਵਾਦ